ਹਾਂਜੀ ਇੱਕ ਵਾਰ ਦੀ ਗੱਲ ਹੈ ਮੈਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਮੈਂ ਪਿਛਲੇ ਮਹੀਨੇ ਉਤਰਾਖੰਡ ਗਿਆ ਸੀਗਾ ਹੇਮਕੁੰਟ ਸਾਹਿਬ ਦੀ ਯਾਤਰਾ ਅਤੇ ਉੱਥੇ ਮੈਨੂੰ ਕਾਫੀ ਬਰਫ਼ੀਲੇ ਪਹਾੜ ਦਾ ਅਤੇ ਚੜ੍ਹਾਈ ਕਰਨੀ ਪਈ ਅਤੇ ਪਰੌਬਲਮ ਇਹ ਆਈ ਕਿ ਉਹ ਜਦੋਂ ਆਪਾਂ ਉੱਥੇ ਚ ਪਹਾੜ ਚੜ੍ਹ ਰਹੇ ਸੀ ਤਾਂ ਉਹ ਜਿਹੜੀ ਬਰਫ਼ ਸੀ ਉਹ ਕਾਫ਼ੀ ਉੱਥੇ ਪੈਰ ਸਲਿੱਪ ਕਰ ਰਹੇ ਸੀ ਅਤੇ ਉੱਥੇ ਦੁਰਘਟਨਾ ਦਾ ਜਿਹੜਾ ਸੀਗਾ ਕਾਰਨ ਬਣ ਰਹੇ ਸੀਗੇ ਅਤੇ ਉਸ ਕਰਕੇ ਮੈਨੂੰ ਦਿੱਕਤ ਕਰਨੀ ਪਈ ਉੱਥੇ